ਜਦੋਂ ਵੀ ਅਸੀਂ ਕਿਤੇ ਲੰਬੇ ਸਫਰ 'ਤੇ ਜਾਣਾ ਹੁੰਦਾ ਹੈਗਾ ਥੋੜ੍ਹੀਆਂ ਜਿਹੀਆਂ ਚੀਜ਼ਾਂ ਹੈਗੀਆਂ ਨੇ ਜਿਹਨਾਂ ਦਾ ਆਪਾਂ ਨੂੰ ਪਹਿਲਾਂ ਹੀ ਚੱਲਣ ਤੋਂ ਪਹਿਲਾਂ ਹੀ ਧਿਆਨ ਰੱਖਣਾ ਹੁੰਦਾ ਹੈਗਾ ਜਿੱਦਾਂ ਕਿ ਬਾਈਕ ਦੀ ਜਿਹੜੀ ਹੈਗੀ ਹੈ ਟਾਈਮ ਦੇ ਉੱਤੇ ਅਤੇ ਚੱਲਣ ਤੋਂ ਪਹਿਲਾਂ ਜਿਹੜੀ ਹੈਗੀ ਇਹਦੀ ਸਰਵਿਸ ਕਰਵਾ ਲਈ ਜਾਵੇ ਇੰਜਨ ਆਇਲ ਨੂੰ ਚੈੱਕ ਕਰ ਲਿਆ ਜਾਵੇ ਜਿਹੜਾ ਕੂਲੈਂਟ ਹੈਗਾ ਆ ਉਹ ਪ੍ਰੋਪਰ ਪੂਰਾ ਹੋਣਾ ਚਾਹੀਦਾ ਹੈਗਾ ਆ ਪ੍ਰੋਪਰ ਕੁਆਂਟਿਟੀ ਦਾ ਹੋਣਾ ਚਾਹੀਦਾ ਕੁਆਲਿਟੀ ਦਾ ਵੀ ਹੋਣਾ ਚਾਹੀਦਾ ਹੈਗਾ ਆ ਇਹ ਅਸੀਂ ਇਨਸੋਰ ਕਰਕੇ ਰੱਖਣਾ ਹੈਗਾ ਆ ਜਿਹੜਾ ਤੇਲ ਹੈਗਾ ਆ ਤੇਲ ਸਾਫ ਜਗ੍ਹਾ ਤੋਂ ਪਵਾਇਆ ਜਾਵੇ ਤਾਂ ਜੋ ਅੱਗੇ ਜਾ ਕੇ ਕਿਤੇ ਕਚਰਾ ਜਿਹੜਾ ਹੈਗਾ ਆ ਇੰਜਨ ਨੂੰ ਕੋਈ ਨੁਕਸਾਨ ਨਾ ਕਰ ਸਕੇ ਅਤੇ ਅਡੀਸ਼ਨ ਦੇ ਵਿੱਚ ਵੀ ਕਿਤੇ ਤੇਲ ਰਸਤੇ 'ਚ ਨਾ ਖਤਮ ਹੋ ਜਾਏ ਐਡੀਸ਼ਨਲ ਇੱਕ ਟੈਂਕੀ ਜਿਹੜੀ ਹੈਗੀ ਆ ਆਇਲ ਦੀ ਆਪਣੇ ਨਾਲ ਰੱਖਣੀ ਚਾਹੀਦੀ ਹੈਗੀ ਆ ਟਾਇਰਾਂ ਦੇ ਵਿੱਚ ਪ੍ਰੋਪਰ ਹਵਾ ਹੋਣੀ ਚਾਹੀਦੀ ਹੈਗੀ ਆ ਟਾਇਰ ਜਿਹੜੇ ਹੈਗੇ ਨੇ ਚੰਗੀ ਕੁਆਲਿਟੀ ਦੇ ਹੋਣੇ ਚਾਹੀਦੇ ਹੈਗੇ ਨੇ ਇਹ ਕੁਛ ਕੁ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਬਾਈਕਰ ਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ ਕਿਸੇ ਵੀ ਲੰਬੇ ਸਫਰ 'ਤੇ ਜਾਣ ਤੋਂ ਪਹਿਲਾਂ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਕਈ ਵਾਰੀ ਕੀ ਹੈਗਾ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈਗੀ ਜਦੋਂ ਮੈਂ ਇੱਕ ਵਾਰੀ ਲੇਹ ਲੱਦਾਖ ਦੇ ਟੂਰ 'ਤੇ ਗਿਆ ਸੀਗਾ ਅਸੀਂ ਗਰੁੱਪ ਸੀਗਾ ਅਤੇ ਸਾਡਾ ਕੀ ਹੋਇਆ ਰਸਤੇ ਦੇ ਵਿੱਚ ਕੀ ਹੋਇਆ ਟਾਇਰ ਪੈਂਚਰ ਹੋ ਗਿਆ ਹੁਣ ਇੰਨੇ ਲੰਬੇ ਰੂਟ ਦੇ ਉੱਤੇ ਜਿਹੜਾ ਹੈਗਾ ਜਲਦੀ ਕਿਤੇ ਕੋਈ ਮਕੈਨਿਕ ਲੱਭਦਾ ਨਹੀਂ ਹੁੰਦਾ ਹੈਗਾ ਪੰਚਰ ਲਗਾਉਣ ਦੇ ਲਈ ਅਤੇ ਇਸ ਕਰਕੇ ਜਿਹੜਾ ਹੈਗਾ ਅਸ ਮੈਂ ਆਪਣੇ ਕੋਲ ਇੱਕ ਸੈਟ ਪੂਰਾ ਰੱਖਿਆ ਹੋਇਆ ਸੀਗਾ ਜਿਹੜਾ ਮੈਂ ਮੌਕੇ ਦੇ ਉੱਤੇ ਇੱਕ ਛੋਟਾ ਪੰਪ ਅਤੇ ਇੱਕ ਜਿਹੜਾ ਪੈਚ ਨਾਲ ਰੱਖਿਆ ਹੋਇਆ ਸੀ ਜਿਹਦੇ ਨਾਲ ਮੈਂ ਪੰਚਰ ਲਗਾ ਸਕਾਂ ਅਤੇ ਮੈਂ ਰਸਤੇ 'ਚ ਰੋਕ ਕੇ ਜਿਹੜਾ ਹੈਗਾ ਬੜੇ ਆਰਾਮ ਦੇ ਨਾਲ ਟਾਈਮ ਜ਼ਰੂਰ ਲੱਗਦਾ ਹੈਗਾ ਕਿਉਂਕਿ ਤੁਸੀਂ ਰੂਟੀਨ 'ਚ ਇਹ ਚੀਜ਼ਾਂ ਨਹੀਂ ਕਰਦੇ ਪਰ ਮੈਂ ਪੰਚਰ ਆਪਣੇ ਆਪ ਨਾਲ ਆਪਣੇ ਆਪ ਲਗਾ ਕੇ ਅਤੇ ਬਾਈਕ ਨੂੰ ਆਪਣਾ ਚੱਲਦਾ ਕੀਤਾ ਸੀ ਔਰ ਬੜਾ ਬਾਕੀ ਦਾ ਰਾਹ ਬਹੁਤ ਵਧੀਆ ਮੇਰਾ ਨਿਕਲਿਆ ਧੰਨਵਾਦ ਜੀ